ਭਾਰਤ ਇੱਕ ਬਹੁਤ ਹੀ ਪ੍ਰਸਿੱਧ ਦੇਸ਼ ਹੈ ਇਸ ਇਸ ਵਿੱਚ ਬਹੁਤ ਹੀ ਸਾਰੀਆਂ ਪ੍ਰਸਿੱਧ ਜਗ੍ਹਾ ਹਨ ਜਿਵੇਂ ਕਿ ਲਾਲ ਕਿਲ੍ਹਾ ਤਾਜ ਮਹਿਲ ਅਤੇ ਪੁਰਾਣੇ ਮਹਿਲ ਮੰਦਰ ਅਤੇ ਮਸਜਿਦ ਅਤੇ ਗੁਰਦੁਆਰਾ ਪਰ ਮੈਂ ਸਿੱਖ ਧਰਮ ਨੂੰ ਬਿਲੌਂਗ ਕਰਦਾ ਹਾਂ ਤਾਂ ਇਸ ਲਈ ਮੈਂ ਆਪ ਜੀ ਨੂੰ ਸ਼੍ਰੀ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਅਤੇ ਹਜ਼ੂਰ ਸਾਹਿਬ ਸ਼੍ਰੀ ਗੁਰਦੁਆਰਾ ਹਰਿਮੰਦਰ ਸਾਹਿਬ ਬਾਰੇ ਕੁਛ ਦੱਸਣਾ ਚਾਹੁੰਦਾ ਹਾਂ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਉੱਤਰਾਖੰਡ ਵਿੱਚ ਸਥਾਪਿਤ ਹੈ ਜੋ ਕਿ ਬਹੁਤ ਹੀ ਠੰਡਾ ਏਰੀਆ ਹੈ ਇੱਥੇ ਸਾਲ ਵਿੱਚ ਸੱਤ ਮਹੀਨੇ ਮੋਸਟਲੀ ਬਰਫ ਬਰਫ ਨਾਲ ਘਿਰਿਆ ਰਹਿੰਦਾ ਹੈ ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਹਿਲੀ ਵਾਰ ਇੱਥੇ ਗਏ ਸਨ ਇਹ ਬਹੁਤ ਹੀ ਉੱਚੀ ਉਚਾਈ 'ਤੇ ਬਣਿਆ ਹੋਇਆ ਹੈ ਅਤੇ ਇੱਥੇ ਅਤੇ ਇਸ ਸਮੇਂ ਬਹੁਤ ਸਾਰੇ ਲੋਕ ਇੱਥੇ ਆਉਂਦੇ ਹਨ ਅਤੇ ਅਤੇ ਇੱਥੇ ਬਾਹਰ ਤੋਂ ਵੀ ਲੋਕ ਜ਼ਿਆਦਾ ਇੱਥੇ ਆਉਂਦੇ ਹਨ ਇੱਥੇ ਮੱਥਾ ਟੇਕਦੇ ਹਨ ਅਤੇ ਇਸ ਤੋਂ ਇਲਾਵਾ ਸ਼੍ਰੀ ਹਜ਼ੂਰ ਸਾਹਿਬ ਜੋ ਕਿ ਮਹਾਰਾਸ਼ਟਰਾ ਵਿੱਚ ਪੈਂਦਾ ਹੈ ਅਤੇ ਇਹ ਬਹੁਤ ਹੀ ਬਹੁਤ ਵਧੀਆ ਮੰਨਿਆ ਜਾਂਦਾ ਹੈ ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਲਾਸਟ ਟਾਇਮ ਉਹਨਾਂ ਨੇ ਇੱਥੇ ਆਪਣਾ ਸਮਾਂ ਬਤੀਤ ਕੀਤਾ ਸੀ ਅਤੇ ਉਹਨਾਂ ਦੀ ਨਸਲ ਦਾ ਘੋੜਾ ਵੀ ਇੱਥੇ ਸਥਾਪਿਤ ਹੈ ਜੋ ਕਿ ਬਹੁਤ ਹੀ ਵਧੀਆ ਹੈ ਅਤੇ ਬਹੁਤ ਹੀ ਲੋਕ ਇੱਥੇ ਪਹੁੰਚਦੇ ਹਨ ਅਤੇ ਇਸ ਤੋਂ ਇਲਾਵਾ ਹਰਿਮੰਦਰ ਸਾਹਿਬ ਜੋ ਕਿ ਬਹੁਤ ਹੀ ਮਹੱਤਵਪੂਰਨ ਅਤੇ ਪ੍ਰਸਿੱਧ ਮੰਨਿਆ ਜਾਂਦਾ ਹੈ ਇਹ ਗੋਲਡ ਇਹ ਗੋਲਡ ਦੇ ਨਾਲ ਬਣਿਆ ਹੋਇਆ ਹੈ ਘਿਰਿਆ ਹੋਇਆ ਹੈ ਇੱਥੇ ਅਲੱਗ ਅਲੱਗ ਕੰਟਰੀਆਂ ਤੋਂ ਬਹੁਤ ਹੀ ਸਾਰੇ ਲੋਕ ਆਉਂਦੇ ਹਨ ਅਤੇ ਇਸ ਨੂੰ ਬਹੁਤ ਹੀ ਪ੍ਰਸਿੱਧ ਅਤੇ ਪ੍ਰਭਾਵਿਤ ਮੰਨਿਆ ਜਾਂਦਾ ਹੈ